ਭਾਰਤੀ ਮਨੋਰੰਜਨ ਉਦਯੋਗ ਦੇ ਵਿਕਾਸ ਵਿੱਚ ਜਿਵੇਂ ਕਿ ਸਾਡੇ ਆਈ ਡੀ ਐੱਸ ਆ ਇੰਟਰਨੈਸ਼ਨਲ ਡਰਾਮਾ ਸਕੂਲ ਹੁੰਦੇ ਨੇ ਉਹਦੇ ਵਿੱਚ ਜੋ ਵੀ ਵਿਅਕਤੀ ਥੀਏਟਰ 'ਚ ਕੰਮ ਕਰਦੇ ਨੇ ਤਾਂ ਉਹਨੂੰ ਉੱਪਰ ਚੁੱਕਣ ਲਈ ਜਿਵੇਂ ਕਿ ਉਹ ਬੰਬੇ 'ਚ ਜਾਂਦੇ ਨੇ ਜਾਂ ਕੁਝ ਵਿਅਕਤੀ ਵਾਪਸ ਹੀ ਮੁੜ ਕੇ ਆਪ ਦੇ ਖੇਤਰਾਂ ਵਿੱਚ ਆ ਜਾਂਦੇ ਨੇ ਤਾਂ ਉਹ ਇੱਕ ਮਨੋਰੰਜਨ ਦਾ ਵੀ ਸਾਧਨ ਬਣ ਜਾਂਦਾ ਲੋਕਾਂ ਲਈ ਜਿਹਦੇ ਵਿੱਚ ਉਦਯੋਗ ਕਹਿ ਸਕਦੇ ਆਪਾਂ ਇਹਨੂੰ ਉਦਯੋਗ ਉਹ ਇਹਦੇ ਵਿੱਚ ਕਮਾ ਸਕਦੇ ਜਦੋਂ ਉਹ ਆਈ ਡੀ ਐੱਸ ਇੰਡੀਅਨ ਨੈਸ਼ਨਲ ਡਰਾਮਾ ਸਕੂਲ ਤੋਂ ਆਪ ਦੀਆਂ ਸਿੱਖਿਆ ਲੈ ਕੇ ਆਉਂਦੇ ਆ ਜਾਂ ਆਪਦੇ ਕੋਰਸ ਪੂਰੇ ਕਰਕੇ ਆਉਂਦੇ ਜਾਂ ਆਪਦੀ ਟ੍ਰੇਨਿੰਗ ਪੂਰੀ ਕਰਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਉਹ ਆਪਦਾ ਉਦਯੋਗ ਖੜ੍ਹਾ ਕਰ ਲੈਂਦੇ ਆ ਉਹਦੇ ਉੱਤੇ ਹੀ ਉਹ ਲੋਕਾਂ ਲਈ ਜਿਵੇਂ ਕਿ ਉਹਨਾਂ ਨੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਆਪਣਾ ਇੱਕ ਥਿਏਟਰ ਖੋਲ੍ਹ ਲਿਆ ਅਤੇ ਉਹਦੇ ਵਿੱਚ ਇੱਕ ਡਰਾਮਾ ਆਪ ਦੀ ਡਰਾਮਾ ਕਮੇਟੀ ਬਣਾ ਲਈ ਉਹ ਲੋਕਾਂ ਦਾ ਮਨੋਰੰਜਨ ਦਾ ਸਾਧਨ ਵੀ ਬਣਦੀ ਹੈ ਲ ਉਹ ਲੋਕਾਂ ਨੂੰ ਉਦਯੋਗ ਵੀ ਮਿਲਦਾ ਬਹੁਤ ਸਾਰੇ ਲੋਕਾਂ ਨੂੰ ਡਰਾਮਾ ਸੈਟ ਲਈ ਬਹੁਤ ਸਾਰੇ ਸਾਨੂੰ ਐਕਟਰ ਚਾਹੀਦੇ ਹੁੰਦੇ ਆ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਦਯੋਗ ਵੀ ਮਿਲਦਾ ਅਤੇ ਉਹ ਜਿਹੜੇ ਸਿੱਖਣ ਵਾਲੇ ਹੁੰਦੇ ਨੇ ਉਹਨਾਂ ਦਾ ਕੰਮ ਵੀ ਸਿੱਖਦੇ ਆ ਅਤੇ ਜਿਹੜਾ ਲੋਕਾਂ ਉਹਨਾਂ ਲਈ ਮਨੋਰੰਜਨ ਦਾ ਸਾਧਨ ਬਣਦੇ ਇਸ ਤੋਂ ਇਲਾਵਾ ਭਾਰਤੀ ਸੰਸਕ੍ਰਿਤੀ ਵਿੱਚ ਜਿਹੜੇ ਨਿਡਰ ਨਿ ਨ੍ਰਿੱਤ ਸੀ ਅਤੇ ਪਹਿਲਾਂ ਜਿਹੜੇ ਮੁਜਰਾ ਕਰਦੇ ਸੀ ਉਹ ਵੀ ਇੱਕ ਮਨੋਰੰਜਨ ਦਾ ਸਾਧਨ ਮੰਨੇ ਜਾਂਦੇ ਸੀ ਜਿਹਨਾਂ ਨੂੰ ਵੀ ਜਿਹੜੇ ਉਹ ਦੇਖਣ ਜਾਂਦੇ ਸੀ ਥੋੜ੍ਹੇ ਥੋੜ੍ਹੇ ਪੈਸੇ ਜਾਂ ਜਿਵੇਂ ਕਿ ਚੀਜ਼ਾਂ ਦਾ ਅਦਾਨ ਪ੍ਰਦਾਨ ਉਹ ਕਰ ਦਿੰਦੇ ਸੀ ਇਸ ਤੋਂ ਇਲਾਵਾ ਵੀ ਭਾਰਤ ਇੱਕ ਬਹੁਤ ਵੱਡਾ ਦੇਸ਼ ਹੋਣ ਕਰਕੇ ਇਹਦੇ ਵਿੱਚ ਉਨੱਤੀ ਸਟੇਟਾਂ ਉਨੱਤੀ ਸਟੇਟਾਂ ਦੇ ਵਿੱਚ ਹਰ ਸਟੇਟ ਦਾ ਆਪਦਾ ਵੱਖਰਾ ਵੱਖਰਾ ਮਨੋਰੰਜਨ ਦੇ ਵੀ ਉਹਨਾਂ ਦੇ ਸਾਧਨ ਨੇ ਜਿਹਦੇ ਵਿੱਚ ਜ਼ਿਆਦਾਤਰ ਜਿਵੇਂ ਕਿ ਪੰਜਾਬ ਦਾ ਲਾ ਲਓ ਇਹਦੇ ਵਿੱਚ ਜਿਵੇਂ ਕਿ ਅਸੀਂ ਕਹਿ ਦਿੰਦੇ ਹਾਂ ਤੀਆਂ ਲੱਗਦੀਆਂ ਗਿੱਧਾ ਬੋਲੀਆਂ ਭੰਗੜਾ ਇਹਨਾਂ ਦੇ ਮਨੋਰੰਜਨ ਦੇ ਸਾਧਨ ਆ ਅਤੇ ਇਹਨਾਂ ਨੂੰ ਉਦਯੋਗਿਕ ਖੇਤਰ ਵਿੱਚ ਜਿਵੇਂ ਆਪਾਂ ਲਿਆਉਣੇ ਜਿਵੇਂ ਕਿ ਵਿਆਹਵਾਂ ਸ਼ਾਦੀਆਂ 'ਤੇ ਭੰਗੜੇ ਦੇ ਗਰੁੱਪ ਜਾਂਦੇ ਆ ਉਹੀ ਪਿੰਡਾਂ 'ਚ ਨੌਜਵਾਨ ਆਪਦੇ ਗਰੁੱਪ ਬਣਾ ਕੇ ਇਹਨਾਂ ਨੂੰ ਉਦਯੋਗਿਕ ਖੇ ਖੇਤਰ ਵਿੱਚ ਲਿਆ ਦਿੰਦੇ ਆ ਕੁੜੀਆਂ ਗਿੱਧੇ ਵਾਲੀਆਂ ਹੁੰਦੀਆਂ ਕੁੜੀਆਂ ਮੁੰਡੇ ਮਲਵਈ ਗਿੱਧਾ ਭੰਗੜੇ ਦੇ ਗਰੁੱਪ ਬਣਾ ਬਣਾ ਕੇ ਇਹਨਾਂ ਨੂੰ ਉਦਯੋਗਿਕ ਖੇਤਰ ਵਿੱਚ ਲਿਆ ਲੈਂਦੇ ਆ